ਪੰਜਾਬ ਵਿੱਚ ਬੈਂਕਿੰਗ ਜਾਂ ਬੀਮਾ ਪਹਿਲ ਕਦਮੀਆਂ ਦੇ ਵਿੱਚ ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ ਜਿਹੜੀ ਕਿ ਬਾਰ੍ਹਾਂ ਰੁਪਇਆ ਪ੍ਰੀਮੀਅਮ ਦੇ ਕੇ ਹਰ ਮਹੀਨੇ ਦੋ ਲੱਖ ਰੁਪਏ ਦੀ ਇੰਸ਼ੋਰੈਂਸ ਹੋ ਜਾਂਦੀ ਹੈ ਇਸ ਤੋਂ ਇਲਾਵਾ ਜਿਸ ਵੀ ਖਾਤਾ ਧਾਰਕ ਕੋਲ ਏ ਟੀ ਐੱਮ ਕਾਰਡ ਹੈ ਉਸ ਦੀ ਵੀ ਇੰਸ਼ੋਰੈਂਸ ਆਟੋਮੈਟਿਕਲੀ ਹੋ ਜਾਂਦੀ ਹੈ ਤੀਸਰਾ ਜਿੱਦਾਂ ਕੋਈ ਮਾਈਕ੍ਰੋ ਇੰਸ਼ੋਰੈਂਸ ਸਕੀਮਾਂ ਵੀ ਪ੍ਰਚਲਿਤ ਹਨ ਕਿ ਛੋਟਾ ਕਿਸੇ ਨੇ ਬਿਜ਼ਨਸ ਕਰਨਾ ਹੈ ਜਿੱਦਾਂ ਡੇਅਰੀ ਦਾ ਧੰਦਾ ਹੈ ਜਿਹਦੇ ਵਿੱਚ ਮੱਝਾਂ ਜਾਂ ਗਾਵਾਂ ਖਰੀਦਣੀਆਂ ਹੁੰਦੀਆਂ ਹਨ ਉਹਨਾਂ ਦੀ ਵੀ ਇੰਸ਼ੋਰੈਂਸ ਕੀਤੀ ਜਾਂਦੀ ਹੈ ਕਿ ਕੱਲ੍ਹ ਨੂੰ ਜੇ ਮੱਝ ਜਾਂ ਗਾਂ ਨੂੰ ਕੁਛ ਹੋ ਜਾਵੇ ਤਾਂ ਉਸਦੇ ਲੋਨ ਦੇ ਪੈਸੇ ਨਾ ਕਵਰ ਕੀਤੇ ਜਾਣ ਤਾਂ ਉਸ ਕੇਸ ਦੇ ਵਿੱਚ ਇਹ ਹੈਲਪਫੁੱਲ ਹੁੰਦਾ ਹੈ